ਭਾਰਤ ਵਿੱਚ ਉਂਝ ਤਾਂ ਬਹੁਤ ਯੋਗਾ ਗੁਰੂ ਹੈ ਕਿਉਂਕਿ ਭਾਰਤ ਯੋਗਾ ਦੇ ਲਈ ੲ ਏਸ਼ੀਆ ਜਿਹੜਾ ਭਾਰਤ ਆ ਇਹ ਯੋਗਾ ਦੇ ਲਈ ਮੰਨਿਆ ਹੋਇਆ ਹੈ ਹਾਲ ਹੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਅਤੇ ਜੋ ਮੈਨੂੰ ਵੀ ਪ੍ਰਭਾਵਿਤ ਕਰਦਾ ਉਹ ਰਾਮਦੇਵ ਹੈ ਗੁਰੂ ਰਾਮਦੇਵ ਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਉਹਦੇ ਤੋਂ ਸੁਭਾਵਿਕ ਹੈ ਤੁਸੀਂ ਪ੍ਰਭਾਵਿਤ ਹੋ ਜਾਂਦੇ ਹੋ ਇਕੱਲਾ ਮੈਂ ਹੀ ਨਹੀਂ ਮੇਰੇ ਬਹੁਤ ਦੋਸਤ ਮਿੱਤਰ ਮੇਰੇ ਬਹੁਤ ਆਂਢੀ ਗੁਆਂਢੀ ਗੁਰੂ ਰਾਮਦੇਵ ਤੋਂ ਪ੍ਰਭਾਵਿਤ ਹਨ ਪ੍ਰਭਾਵਿਤ ਕਿਉਂ ਹਨ ਉਹਨਾਂ ਵਿੱਚ ਕੁਝ ਕੁ ਵਿਸ਼ੇਸ਼ ਗੱਲਾਂ ਜਿਹੜੀਆਂ ਜਿਵੇਂ ਆਪਣੇ ਨਿੱਜੀ ਤੌਰ 'ਤੇ ਗੱਲ ਕਰਾਂ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਇੱਕ ਤਾਂ ਜਦੋਂ ਵੀ ਉਹ ਯੋਗ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਬੜੇ ਹੀ ਸੁਚੱਜੇ ਢੰਗ ਦੇ ਨਾਲ ਦਰਸ਼ਕਾਂ ਨੂੰ ਸੰਬੋਧਿਤ ਹੁੰਦੇ ਨੇ ਰਾਮ ਰਾਮ ਕਹਿ ਕੇ ਉਹ ਭਾਰਤ ਦੀ ਸੰਸਕ੍ਰਿਤੀ ਨਾਲ ਵੀ ਜਿਹੜੀ ਉਹ ਪਛਾਣ ਕਰਵਾਉਂਦੇ ਨੇ ਫੇਰ ਯੋਗ ਕਰਦੇ ਸਮੇਂ ਉਹ ਬੜੇ ਅਨੁਸ਼ਾਸਨ ਦੇ ਵਿੱਚ ਹੈ ਜਿਹੜਾ ਉਹ ਯੋਗ ਕਰਦੇ ਨੇ ਇਹ ਨਹੀਂ ਹੈ ਕਿ ਤੁਸੀਂ ਦੇਖੋਗੇ ਉਹ ਅਨੁਸ਼ਾਸਨਹੀਣ ਹੁੰਦੇ ਹੈ ਕਿਤੋਂ ਵੀ ਦੂਸਰਾ ਉਹ ਸਮੇਂ ਦਾ ਬਹੁਤ ਧਿਆਨ ਰੱਖਦੇ ਆ ਜੇ ਕੋਈ ਯੋਗ ਪ੍ਰਕਿਰਿਆ ਤਿੰਨ ਮਿੰਟ ਦੀ ਹੈ ਤਾਂ ਉਹਨਾਂ ਦੀ ਯੋਗ ਪ੍ਰਕਿਰਿਆ ਤਿੰਨ ਮਿੰਟ ਦੇ ਵਿੱਚ ਹੀ ਹੈ ਜਿਹੜੀ ਉਹ ਖਤਮ ਹੋਊਗੀ ਇਹ ਨਹੀਂ ਹੋਊਗਾ ਵੀ ਕਿਸੇ ਯੋਗ ਪ੍ਰਕਿਰਿਆ ਦੇ ਵਿੱਚ ਉਹ ਚਾਰ ਮਿੰਟ ਤੱਕ ਲੈ ਜਾਣਗੇ ਅਤੇ ਦੂਸਰਾ ਉਹਨਾਂ ਦੇ ਸਰੀਰ ਅਤੇ ਚਿਹਰੇ ਦੇ ਉੱਤੇ ਸਰੀਰ ਦਾ ਪੋਸ਼ਚਰ ਅਤੇ ਚਿਹਰੇ ਦਾ ਤੇਜ਼ ਆ ਜਿਹੜਾ ਉਹ ਤੁਹਾਨੂੰ ਬਹੁਤ ਪ੍ਰਭਾਵਿਤ ਕਰਦਾ ਉਹਦੇ ਪ੍ਰਭਾਵ ਤੋਂ ਬਿਨਾ ਤਾਂ ਮੈਨੂੰ ਇਹ ਲੱਗਦਾ ਵੀ ਤੁਸੀਂ ਬਚ ਰਹਿ ਨਹੀਂ ਸਕਦੇ ਬਚ ਹੀ ਨਹੀਂ ਸਕਦੇ ਧੰਨਵਾਦ